ਪੰਜਾਬ ਦੇ ਵਿੱਚ ਇੰਟਰਨੈਸ਼ਨਲ ਕਾਨਫਰੰਸ ਔਨ ਇਨਵਾਇਰਮੈਂਟਲ ਫੂਡ ਐਗਰੀਕਲਚਰ ਬਾਇਓਟੈਕਨੋਲੋਜੀ ਹੈ ਇਸ ਦੇ ਵਿੱਚ ਪੰਜਾਬ ਦੇ ਵਿੱਚ ਖੇਤੀਬਾੜੀ ਕਿੱਦਾਂ ਹੋ ਰਹੀ ਹੈ ਉਹਦੇ 'ਚ ਕੀ ਸੁਧਾਰ ਹੋ ਸਕਦਾ ਹੈਗਾ ਪੈਸਟੀਸਾਈਡਸ ਨਾਲ ਕੀ ਨੁਕਸਾਨ ਹੋ ਰਹੇ ਹੈ ਉਹ ਸਾਰਾ ਕੁਝ ਇਸ ਦੇ ਵਿੱਚ ਡਿਸਕਸ ਕੀਤਾ ਜਾਂਦਾ ਇੰਟਰਨੈਸ਼ਨਲ ਕਾਨਫਰੰਸ ਔਨ ਐਮਰਜਿੰਗ ਟਰੈਂਡਸ ਇੰਨ ਆਰਟੀਫਿਸ਼ਅਲ ਇੰਟੈਲੀਜੈਂਸ ਹੁਣ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਦਾ ਏਆਈ ਦਾ ਯੁਗ ਹੈ ਆਰਟੀਫਿਸ਼ਅਲ ਇੰਟੈਲੀਜੈਂਸ ਦਾ ਯੁੱਗ ਹੈ ਤਾਂ ਇੱਥੇ ਉਹਦਾ ਜਿਹੜਾ ਟਰੈਂਡ ਹੈਗੇ ਆ ਉਹ ਡਿਸਕਸ ਕੀਤੇ ਜਾਂਦੇ ਆ ਜਿੱਦਾਂ ਆਪਾਂ ਕਹਿ ਸਕਦੇ ਹਾਂ ਹੁਣ ਆਪਣੇ ਚੈਟ ਬੋਟਸ ਬਣੇ ਹੈ ਉਹਨਾਂ ਏਆਈ ਚੈਟ ਬਾਟਸ ਚੈਟ ਜੀਪੀਟੀ ਅਤੇ ਹੁਣ ਜਿਹੜਾ ਏਆਈ ਬਣ ਵੀ ਰਿਹਾ ਹੈਗਾ ਇਹ ਸਾਰਾ ਕੁਝ ਉੱਥੇ ਡਿਸਕਸ ਕੀਤਾ ਜਾਂਦਾ ਹੈਗਾ ਇੰਟਰਨੈਸ਼ਨਲ ਕਾਨਫਰੰਸ ਔਨ ਸਾਇੰਸ ਇੰਜੀਨੀਅਰਿੰਗ ਟੈਕਨੋਲਜੀ ਇਹ ਕਾਨਫਰੰਸ ਦੇ ਵਿੱਚ ਬਾਕੀ ਸਾਰੀਆਂ ਸਾਇੰਸ ਟੈਕਨੋਲਜੀ ਉਹ ਸਾਰਾ ਕੁਝ ਡਿਸਕਸ ਕੀਤਾ ਜਾਂਦਾ ਕਿ ਮੰਨ ਕੇ ਚਲੋ ਜਿਵੇਂ ਇਸਰੋ ਹੈ ਉਹ ਸਪੇਸ ਟੈਕਨੋਲਜੀ ਦੇ ਉੱਤੇ ਜਿਵੇਂ ਡਿਸਕਸ ਕਰ ਰਿਹਾ ਹੈਗਾ ਤਾਂ ਉਹ ਸਭ ਟਾਈਮ ਟੂ ਟਾਈਮ ਕਾਨਫਰੰਸਿਸ ਲਗਾਂਦੇ ਰਹਿੰਦੇ ਆਗੇ ਜਿਹਦੇ ਕਰਕੇ ਇੱਦਾਂ ਹੁੰਦਾ